ਹੈਲੋ ਸਤਿ ਸ਼੍ਰੀ ਅਕਾਲ ਸਰ ਜੱਗੀ ਸਵੀਟ ਤੋਂ ਬੋਲਦੇ ਹੋ ਤੁਸੀਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਸਰ ਆਪਣੇ ਨਾ ਘਰ 'ਚ ਸਿਸਟਰ ਦੀ ਮੈਰਿਜ ਹੈ ਆਪਾਂ ਉਹਦੇ ਵਿਆਹ ਲਈ ਨਾ ਮਠਿਆਈਆਂ ਚਾਹੀਦੀਆਂ ਸੀ ਹੈ ਨਾ ਮੈਂ ਇਹ ਪੁੱਛਣਾ ਸੀ ਆਪਣੇ ਕੀ ਰੇਟ ਚਲਦਾ ਹੈ ਨਾ ਅਤੇ ਰੇਟ ਮੈਨੂੰ ਇਹ ਦੱਸੋ ਕਿਲੋ ਦੇ ਹਿਸਾਬ ਨਾਲ ਕਰੋਗੇ ਕਿ ਡੱਬਿਆਂ ਦੇ ਹਿਸਾਬ ਨਾਲ ਅਤੇ ਮਠਿਆਈ 'ਚ ਆਪਾਂ ਨੂੰ ਕੀ ਕੀ ਮਿਲੇਗਾ ਹੈ ਨਾ ਅਤੇ ਉਹ ਤੁਸੀਂ ਪਹੁੰਚਾਉਗੇ ਕਿਵੇਂ ਹੈ ਨਾ ਅਤੇ ਉਹ ਸਾਰਾ ਵਗੈਰਾ ਹੈ ਨਾ ਜੋ ਵੀ ਬਾਇਓਡਾਟਾ ਹੁੰਦਾ ਹੈ ਨਾ ਰੇਟ ਵਗੈਰਾ ਉਹ ਮੈਨੂੰ ਵਟਸਐਪ ਕਰ ਦਿਉ ਹੈ ਨਾ ਜੇ ਤੁਸੀਂ ਮੈਨੂੰ ਇਹਦੇ 'ਤੇ ਫੋਨ 'ਤੇ ਦੱਸਣਾ ਚਾਹੁੰਦੇ ਫੋਨ 'ਤੇ ਵੀ ਦੱਸ ਦਿਉ ਹੈ ਨਾ ਜੋ ਮੈਂ ਆਪਣੇ ਘਰ ਵੀ ਗੱਲ ਸ ਕਰ ਸਕਾਂ ਅਤੇ ਬਾਕੀ ਅਸੀਂ ਹੋਰਨਾ ਵੀ ਪੁੱਛ ਲਈਏ ਨਹੀਂ ਹੈ ਨਾ ਜੇ ਸਾਨੂੰ ਰੇਟ ਸਹੀ ਲੱਗ ਰਿਹਾ ਤਾਂ ਪਲੀਜ਼ ਮੈਨੂੰ ਦੱਸਿਉ ਰੇਟ ਅਤੇ ਮੈਂ ਤੁਹਾਨੂੰ ਦੁਬਾਰਾ ਹੈ ਨਾ ਕੋਲ ਕਰਦਾ ਠੀਕ ਹੈ ਸਰ ਥੈਂਕ ਯੂ